ਮੈਂ ਸਵੇਰ ਨੂੰ ਦਹੀਂ ਨਾਲ ਪਰਾਂਠੇ ਖਾਂਦੀ ਹਾਂ ਅਤੇ ਦੁਪਹਿਰ ਨੂੰ ਚਾਵਲ ਜਿੱਦਾਂ ਮਤਲਬ ਕਿ ਦਾਲ ਚਾਵਲ ਕੜੀ ਚਾਵਲ ਲਿਕੁਇਡ ਸਬਜ਼ੀ ਨਾਲ ਚਾਵਲ ਖਾਂਦੀ ਹਾਂ ਅਤੇ ਨਾਲ ਇੱਕ ਇੱਕ ਰੋਟੀ ਅਤੇ ਨਾਲ ਦਹੀਂ ਖਾਂਦੀ ਹਾਂ ਅਤੇ ਸ਼ਾਮ ਨੂੰ ਮੈਂ ਚਾਹ ਪੀਂਦੀ ਹਾਂ ਅਤੇ ਸੋਣ ਰਾਤ ਨੂੰ ਮੈਂ ਹਰੀ ਸਬਜ਼ੀਆਂ ਹਰੀ ਸਬਜ਼ੀ ਸਬਜ਼ੀ ਨਾਲ ਮਤਲਬ ਕਿ ਰੋਟੀਆਂ ਖਾਂਦੀ ਹਾਂ ਅਤੇ ਸੋਣ ਟਾਈਮ ਮੈਂ ਦੁੱਧ ਪੀਂਦੀ ਹਾਂ ਅਤੇ ਹੋਰ ਵੀ ਦਿਨ ਵਿੱਚ ਕਈ ਵਾਰ ਐਕਸਟ੍ਰਾ ਫੂਡ ਐਕਸਟ੍ਰਾ ਮੀਲ ਮਤਲਬ ਕਿ ਜਿਵੇਂ ਫਾਸਟ ਫੂਡ ਸਮੋਸੇ ਵਗੈਰਾ ਖਾ ਲੈਂਦੀ ਹਾਂ ਅਤੇ ਹੋਰ ਵੀ ਫਰੂਟਸ ਵਗੈਰਾ ਵੀ ਅਸੀਂ ਦਿਨ 'ਚ ਖਾਂਦੇ ਹਾਂ ਅਤੇ ਰੋਟੀ ਦੇ ਨਾਲ਼ ਸਲਾਦ ਖਾਂਦੇ ਹਾਂ ਲੱਸੀ ਪੀਂਦੇ ਹਾਂ ਬਸ ਰੋਟੀ ਦੇ ਨਾਲ ਸਲਾਦ ਖਾਂਦੀ ਹਾਂ ਅਤੇ ਲੱਸੀ ਪੀਂਦੀ ਹਾਂ ਸੰਤੁਲਿਤ ਖੁਰਾਕ ਚੰਗੀ ਸਿਹ ਚੰਗੀ ਸਿਹਤ ਵਿੱਚ ਬਹੁਤ ਹੀ ਜ਼ਿਆਦਾ ਯੋਗਦਾਨ ਪਾਉਂਦੀ ਹੈ ਸੰਤੁਲਿਤ ਭੋਜਨ ਖਾਣ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਦਿਮਾਗ਼ ਚੁਸਤ ਰਹਿੰਦਾ ਹੈ ਸਾਡਾ ਸਰੀਰ ਫੁਰਤੀਲਾ ਰਹਿੰਦਾ ਹੈ ਸਾਨੂੰ ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਖਾਣੀ ਚਾਹੀਦੀਆਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ ਸਾ ਅਤੇ ਸਾਨੂੰ ਚੰਗੇ ਸ ਸਾਨੂੰ ਚੰਗੀ ਸਬਜ਼ੀਆਂ ਚੌਲ ਚੌਲ ਅਤੇ ਵਧੀਆ ਅਨਾਜ ਮਿਲਦਾ ਹੈ ਮਤਲਬ ਕਿ ਸਾ ਸਾਡੇ ਪਿੰਡਾਂ ਵਿੱਚ ਚਾਵ ਚਾਵਲ ਕਣਕ ਅਤੇ ਮੱਕੀ ਵੀ ਉਗਾਈ ਜਾਂਦੀ ਹੈ ਸਾਨੂੰ ਬਹੁਤ ਹੀ ਬਲਕਿ ਵਧੀਆ ਅਨਾਜ ਮਿਲਦਾ ਹੈ ਸਾਨੂੰ ਪਿਓ ਪਿਓਰ ਆਟਾ ਵੀ ਮਿਲਦਾ ਪਿਓਰ ਆਟਾ ਪਿਓਰ ਰੋਟੀਆਂ ਮਤਲਬ ਕਿ ਵਧੀਆ ਵਧੀਆ ਖਾਣਾ ਖਾਣ ਨੂੰ ਮਿਲਦਾ ਹੈ